ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਮੇਰੇ ਕੋਲ ਕੱਲ੍ਹ ਸੁਬਾਹ ਆ ਜਿਓ ਜੀ ਤੁਸੀਂ ਆ ਜਿਓ ਜੀ ਨੌਂ ਵਜੇ ਤੱਕ ਜੀ ਹਾਂਜੀ ਹਾਂਜੀ ਅੱਗੇ ਪਿੱਛੇ ਤੁਸੀਂ ਕਰ ਸਕਦੇ ਹਾਂਜੀ ਆ ਜੋਗੇ ਹਾਂਜੀ ਨਹੀਂ ਆ ਅੱਗੇ ਪਿੱਛੇ ਕਰ ਸਕਦੇ ਆਪਾਂ ਜਦੋਂ ਤੁਹਾਡੇ ਕੋਲ ਟਾਈਮ ਹੋ ਹਾਂਜੀ ਮੈਂ ਤਾਂ ਵੈਸੇ ਜੀ ਇੱਕ ਵਜੇ ਤੱਕ ਹੁੰਦਾ ਉਸ ਤੋਂ ਬਾਅਦ ਘੰਟਾ ਖਾਣਾ ਖਾਣ 'ਚ ਚਲ ਜਾਂਦੇ ਆ ਫਿਰ ਉਸ ਤੋਂ ਬਾਅਦ ਫਿਰ ਆ ਜਾਈਦਾ ਜੀ ਤਿੰਨ ਵਜੇ ਤੱਕ ਹਾਂਜੀ ਇਹ ਆਪਣੇ ਜ਼ਿਆਦਾਤਰ ਹੋ ਜਾਂਦੀ ਖੰਡਾ ਠੰਡਾ ਜਾਂ ਗਰਮ ਖਾਣ ਦੇ ਕਾਰਨ ਹੋ ਜਾਂਦਾ ਜੀ ਜੇ ਆਪਾਂ ਜਦੋਂ ਰੋ ਰੋਟੀ ਖਾ ਲੈਂਦੇ ਸੁਬਾਹ ਕੁਰਲਾ ਨਹੀਂ ਕਰਦੇ ਕੁਰਲਾ ਕਰਨ ਨਾ ਕਰਨ ਦੇ ਕਾਰਨ ਆਪਣੇ ਜੋ ਖਾਣਾ ਖਾਧਾ ਹੁੰਦਾ ਉਹ ਆਪਣੇ ਦੰਦਾਂ ਵਿੱਚ ਰਹਿ ਜਾਂਦਾ ਫਸ ਜਾਂਦਾ ਇਸ ਕਰਕੇ ਆਪਣੇ ਦੰਦਾਂ ਦੀ ਦਰਦ ਸ਼ੁਰੂ ਹੋ ਜਾਣ

ਅੱਛਾ ਜੀ

ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਕੱਲ੍ਹ ਸੁਬਾਹ ਆ ਜਿਓ ਫਿਰ ਜਦ ਤੁਹਾਡਾ ਟਾਈਮ ਲੱਗੇ ਨੌਂ ਤੋਂ ਲੈ ਕੇ ਬਾਰ੍ਹਾਂ ਵਜੇ ਤੱਕ ਇੱਕ ਮਿੰਟ

ਨਾ ਨਾ ਵੋਤ ਹੈ ਨਹੀਂ ਜੀ

ਹਾਂਜੀ ਨਹੀਂ ਤੁਹਾਨੂੰ ਦੋਨੋਂ ਕੱਠੀਆਂ ਮਿਲਣਗੀਆਂ ਦੇਸੀ ਮਿਲੇਗੀ ਨਾਲ ਅੰਗਰੇਜ਼ੀ ਦੋਨੋਂ ਦਿਆਂਗੇ ਜੀ

ਹਾਂਜੀ ਹਾਂਜੀ ਫਿਕਰ ਗਰਮ ਮਤਲਬ ਕੋਈ ਚੀਜ਼ ਨਾ ਠੰਡੀ ਖਾਣੀ ਘਰੇ ਬੰਦ ਕਰ ਦਿਓ ਅਤੇ ਸੁਬਹਾ ਸਵੇਰੇ ਆ ਜਾਈਓ ਮੇਰੇ ਕੋਲ ਹਾਂਜੀ ਹਾਂਜੀ ਹਾਂਜੀ ਹਲਕੀ ਫੁਲਕੀ ਖਾ ਲਿਓ ਜੇ ਜ਼ਿਆਦਾ ਮਤਲਬ ਹਲ ਕਈ ਵਾਰ ਰੋਟੀ ਥੋੜ੍ਹੀ ਟਾਈਟ ਹੁੰਦੀ ਹੈ ਨੋਰਮਲ ਫੁਲਕਾ ਖਾਇਆ ਜੀ ਹਲਕਾ ਜਿਹਾ ਠੀਕ ਹੈ ਜੀ ਥੈਂਕ ਯੂ ਜੀ